ਭਾਰਤ ਸਮਾਜ ਵਿੱਚ ਧਰਮ ਦੀ ਅਲੱਗ ਅਲੱਗ ਭੂਮਿਕਾ ਹਨ ਹਰੇਕ ਧਰਮ ਦੀ ਆਪੋ ਆਪਣੀ ਭੂਮਿਕਾ ਹੈ ਜਿੱਦਾਂ ਸਿੱਖ ਧਰਮ ਆਪਣਾ ਹੈ ਅਤੇ ਮੁਸਲਮਾਨ ਆਪਣਾ ਹਿੰਦੂ ਧਰਮ ਆਪ ਅਲੱਗ ਏ ਪਰ ਭਗਵਾਨ ਸਾਰਿਆਂ ਦਾ ਇੱਕ ਹੈ ਸਾਰੇ ਭਗਵਾਨ ਦੀ ਪੂਜਾ ਕਰਨਾ ਚਾਹੁੰਦੇ ਹਨ ਅਤੇ ਆਪਸ ਵਿੱਚ ਏਕਤਾ ਬਣਾਈ ਰੱਖਣਾ ਚਾਹੁੰਦੇ ਹਨ ਅਤੇ ਨਾਗਰਿਕ ਦੀ ਹਜੇ ਨਾਗਰਿਕ ਵਜੋਂ ਲੋਕਾਂ ਦਾ ਸੋ ਇਸ ਮਦਦ ਕਰਨ ਮਦਦ ਕਰਨੀ ਚਾਹੀਦੀ ਹੈ ਕਿਸੇ ਨੂੰ ਵੇਖ ਕੇ ਪਿੱਛੇ ਨਹੀਂ ਹਟਣਾ ਚਾਹੀਦਾ ਹਰੇਕ ਧਰਮ ਦੀ ਆਪੋ ਆਪਣੀ ਭੂਮਿਕਾ ਹੁੰਦੀ ਹੈ ਹਰੇਕ ਆਪਣਾ ਹਿਸਾ ਆਪਣੇ ਆਪਣੇ ਹਿਸਾਬ ਨਾਲ ਆਪਣੇ ਭਗਵਾਨ ਦੀ ਪੂਜਾ ਕਰਦਾ ਹੈ ਅਤੇ ਨਾ ਇਹਦੀ ਕ ਨਾਗਰਿਕ ਵਜੋਂ ਲੋਕਾਂ ਨੂੰ ਕੋਈ ਮੁਸੀਬਤ ਵਿੱਚ ਹੋਵੇ ਵੇਖ ਕੇ ਪਿੱਛੇ ਨਹੀਂ ਹਟਣਾ ਚਾਹੀਦਾ ਸਗੋਂ ਉਹਦੀ ਜਾ ਕੇ ਮਦਦ ਕਰਨੀ ਚਾਹੀਦੀ ਹੈ ਕੋਈ ਪੈਸਾ ਮੰਗੇ ਉਹਨੂੰ ਪੈਸਾ ਨਹੀਂ ਦੇਣਾ ਚਾਹੀਦਾ ਕਿਉਂਕਿ ਪੈਸਾ ਲੈ ਕੇ ਉਹ ਧਰਮ ਦਾ ਤ ਨਾਗਰਿਕ ਹੋ ਜਾ ਕੋਈ ਉੱਦਾਂ ਮਦਦ ਕਰੋ ਜਿਸ ਚੀਜ਼ ਦੀ ਉਹਨੂੰ ਲੋੜ ਹੈ ਉਹ ਉਹਦੀ ਲੈ ਕੇ ਦੋ ਇਹ ਸਾਡੀ ਹੀ ਸਾਡੀ ਸਾਡਾ ਇੱਕ ਮ ਨ ਮਾੜੇ ਬੰਦੇ ਨੂੰ ਵੇਖ ਕੇ ਉਹਦਾ ਮਦਦ ਕਰਨਾ ਸਾਡਾ ਇੱਕ ਫਰਜ਼ ਬਣਦਾ ਹੈ ਧਰਮਾਂ ਧਰਮ ਹਰੇਕ ਧਰਮ ਆਪਾਂ ਆਪਣਾ ਧਰਮ ਹੁੰਦਾ ਹੈ ਇਸ ਲਈ ਕਿਸੇ ਵੀ ਧਰਮ ਨੂੰ ਕੋਈ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਭਗਵਾਨ ਸਭ ਦਾ ਇੱਕ ਹੀ ਹੁੰਦਾ ਹੈ ਅਤੇ ਸਭ ਹੀ ਆਪੋ ਆਪਣੇ ਹਿਸਾਬ ਨਾਲ ਉਸਦੀ ਪੂਜਾ ਕਰਦੇ ਹਨ